ਸਤਿ ਸ਼੍ਰੀ ਅਕਾਲ ਬੱਚੇ ਅੱਜ ਕੱਲ੍ਹ ਬਾਰਵੀਂ ਤੋਂ ਬਾਅਦ ਕਾਲਜ ਵਿੱਚ ਐਡਮਿਸ਼ਨ ਲੈਂਦੇ ਨੇ ਉਹਦੇ ਵਿੱਚ ਆਪਾਂ ਬੀ ਸੀ ਏ ਕਰਦੇ ਹਾਂ ਬੱਚੇ ਬੀ ਟੈਕ ਕਰਦੇ ਹੈ ਫਾਰਮੈਸੀ ਕਰਦੇ ਆ ਬਾਓ ਟੈਕਨੋਲੋਜੀ ਕਰਦੇ ਆ ਐਗਰੀਕਲਚਰ ਦਾ ਕੋਰਸ ਕਰਦੇ ਹੈ ਅਤੇ ਉਸ ਤੋਂ ਬਾਅਦ ਕਿ ਨੌਕਰੀ ਵਾਸਤੇ ਬੱਚੇ ਜੋ ਟੈਕਨੋਲੋਜੀ ਨੇ ਕੀਤਾ ਕਿ ਆਪਾਂ ਘਰ ਬੈਠੇ ਬੈਠੇ ਆਪਣੇ ਫਾਰਮ ਭਰ ਸਕਦੇ ਹਾਂ ਘਰ ਬੈਠੇ ਬੈਠੇ ਆਪਾਂ ਆਪਣੀ ਜੋ ਕਿ ਜਿਸ ਚੀਜ਼ ਦਾ ਫਾਰਮ ਭਰੇ ਦਾ ਉਸ ਨੌਕਰੀ ਦੀ ਆਪਾਂ ਤਿਆਰੀ ਕਰ ਸਕਦੇ ਹਾਂ ਅਤੇ ਸਾਨੂੰ ਸਾਡਾ ਇਹਦੇ ਵਿੱਚ ਕੀ ਹੁੰਦਾ ਕਿ ਸਾਡਾ ਟਾਈਮ ਬਚ ਜਾਂਦਾ ਹੈ ਪੈਸੇ ਬਚ ਜਾਂਦੇ ਹੈ ਹੋਰ ਆਪਣਾ ਸਾਡੀ ਸਿਹਤ ਵੀ ਠੀਕ ਰਹਿੰਦੀ ਹੈ ਘਰ ਘਰ ਬੈਠਰ ਬੈਠਣ ਨਾਲ ਸਾਨੂੰ ਕੋਈ ਕ ਕੋਈ ਡਰ ਨਹੀਂ ਹੁੰਦਾ ਕਿਤੇ ਸਾਡੇ ਸੱਟ ਪਿਟ ਲੱਗਣ ਦਾ ਕਿਤੇ ਜਾਣ ਨਾਲ ਅਤੇ ਉਸ ਤੋਂ ਬਾਅਦ ਕਿ ਬੱਚੇ ਅੱਜ ਕੱਲ੍ਹ ਆਈ ਟੀ ਆਈ ਆਈ ਟੀ ਕਰਦੇ ਹਾਂ ਉਹਦੇ ਵਿੱਚ ਆਪਣਾ ਜੋ ਜਿਨ੍ਹਾਂ ਨੇ ਇੰਜੀਨੀਅਰ ਬਣਨਾ ਹੁੰਦਾ ਉਹ ਆਈ ਆਈ ਟੀ ਕਰਦੇ ਹੈ ਜਿਨ੍ਹਾਂ ਨੇ ਡਾਕਟਰ ਬਣਨਾ ਹੁੰਦਾ ਹੈ ਉਹ ਨੀਟ ਦੀ ਤਿਆਰੀ ਕਰਦੇ ਹੈ ਉਹ ਨੀਟ ਦੀ ਤਿਆਰੀ ਕਰਦੇ ਹੈ ਅਤੇ ਜਿਨ੍ਹਾਂ ਨੇ ਆਪਾਂ ਜਿਨ੍ਹਾਂ ਨੇ ਆਪਣਾ ਮੈਡੀਕਲ ਸਟੋਰ ਖੋਲ੍ਹਣਾ ਹੁੰਦਾ ਉਹ ਫਾਰਮੈਸੀ ਕਰ ਲੈਂਦਾ ਹੈ ਅਤੇ ਫਿਰ ਮੈਡੀਕਲ ਸਟੋਰ ਖੋਲ੍ਹ ਲੈਂਦਾ ਹੈ ਧੰਨਵਾਦ